ਹੈਲੋ ਹਾਂਜੀ ਹਾਂਜੀ ਉੱਥੇ ਬੋਲ ਰਿਹਾ ਅੱਛਾ ਕਿਹੜੇ ਸਮੈਸਟਰ ਦੀਆਂ ਤੇ ਕਿਹੜਾ ਸਬਜੈਕਟ ਹੈ ਪੋਲ ਸਾਇੰਸ ਤੇ ਪਬਲਿਸ਼ਰ ਕਿਹੜਾ ਚਾਹੀਦਾ ਤੁਹਾਨੂੰ ਅੱਛਾ ਜੀ ਮਿਲ ਜਾਣਗੀਆ ਕੋਈ ਨਹੀਂ ਸੈਕਿੰਡ ਹੈਂਡ ਦੇਖਣੀਆਂ ਪੈਣਗੀਆਂ ਹੋਈਆਂ ਤੁਸੀਂ ਇੱਕ ਵਾਰ ਨਾਮ ਦੱਸ ਦੋ ਬੁੱਕਸ ਜਿਹੜੇ ਤੁਸੀਂ ਲੈਣੀਆਂ ਨੇ ਹਾਂਜੀ ਹਾਂਜੀ

ਅੱਛਾ ਇਹ ਕੰਪੈਰਟਿਵ ਤੇ ਡੈਮੋਕਰੇਸੀ ਦੀ ਤਾਂ ਸੇਕਿੰਡ ਹੈਂਡ ਮਿਲ ਜਾਏਗੀ ਤੇ ਇੰਟਰਨੈਸ਼ਨਲ ਤਾਂ ਤੁਹਾਨੂੰ ਨਿਉ ਹੀ ਲੈਣੀ ਪੈਣੀ ਹੈ ਉਹ ਤੁਹਾਨੂੰ ਮੰਗਵਾ ਕੇ ਦੇ ਦਵਾਂਗੇ ਹਾਂਜੀ ਉਹੀ ਸਿਲੇਬਸ ਲੈ ਕੇ ਦੇਵਾਂਗਾ ਹਾਂਜੀ ਫੌਰਥ ਤੇ ਥਰਡ ਸਮੈਸਟਰ ਹਾਂ ਬਈ ਇਹਦੇ ਤੋਂ ਅਲੇਬਲ ਨੇ ਬੁਕਸ ਕੁਛ ਜਿਵੇਂ ਜਿਹੜੇ ਹੁੰਦੇ ਨਾ ਜਿਹੜਾ ਖੁਦ ਦੇ ਸਬਜੈਕਟ ਉਹ ਥੋੜੇ ਮਤਲਬ ਹੋ ਜਾਂਦਾ ਮੁਸ਼ਕਿਲ ਸੈਕਿੰਡ ਹੈਂਡ ਉਹ ਤੁਹਾਨੂੰ ਨਵੀਂਆਂ ਲੈਣੀਆਂ ਪੈਣਗੀਆਂ ਤੇ ਬਾਕੀ ਜਿਹੜੇ ਕੰਬਲਸ ਸਬਜੈਕਟ ਨੇ ਉਹ ਤੁਹਾਨੂੰ ਸੈਕਿੰਡ ਹੈਂਡ ਮਿਲ ਜਾਣਗੇ ਐਮ ਏ ਦਾ ਇੱਕ ਬੁੱਕ ਜਿਵੇਂ ਤੁਸੀਂ ਡੈਮੋਕਰੇਸੀ ਤੇ ਕੰਪੈਰਟਿਵ ਕਹਿ ਰਹੇ ਹੋ ਉਹਨਾਂ ਦਾ ਤਿੰਨ ਸੌ ਲਵਾਂਗੇ ਅਸੀਂ ਸੈਕਿੰਡ ਹੈਂਡ ਦਾ ਤੇ ਜਿਹੜੇ ਨਵੀਂ ਹੈਗੀ ਹੈ ਉਹ ਤੁਹਾਨੂੰ ਪਤਾ ਹੀ ਹੈ ਚਾਰ ਸੌ ਸਾਢੇ ਚਾਰ ਸੌ ਪੰਜ ਸੌ ਤੱਕ ਆ ਜਾਂਦੀ ਹੈ ਫੇਰ ਮਤਲਬ ਬੁੱਕ ਨਾਲ ਥੋੜੇ ਘੱਟ ਹੀ ਤੁਹਾਨੂੰ ਪੈਣਗੇ ਮਤਲਬ ਜਿਵੇਂ ਬੁੱਕ ਪੰਜ ਸੌ ਦੀ ਹੈਗੀ ਹੈ ਫਿਰ ਅਸੀਂ ਤੁਹਾਨੂੰ ਚਾਰ ਸੌ ਤੱਕ ਲਾ ਲਾਂਗੇ ਹੁਣ ਸਾਡੇ ਨਾਲ ਬੁੱਕ ਜਾ ਤਾਂ ਪਤਾ ਕਰਨੀ ਪੈਣੀ ਕਿਸੇ ਤੋਂ ਜੇ ਤੁਸੀਂ ਫੋਟੋ ਸਟੇਟ ਹੀ ਲੈਣੀ ਹੈ ਤੇ ਪਤਾ ਕਰਨ ਚ ਟਾਈਮ ਲੱਗੇਗਾ ਥੋੜਾ ਫਿਰ ਤੁਹਾਨੂੰ ਚਾਰ ਪੰਜ ਦਿਨ ਵੇਟ ਕਰਨੀ ਪੈਣੀ ਹੈ ਸੈਕਿੰਡ ਹੈਂਡ ਹਾਂਜੀ ਤਾਂ ਟਾਈਮ ਲੱਗੇਗਾ ਫਿਰ ਸੈਕਿੰਡ ਬੱਚੇ ਤੋਂ ਹੀ ਪਤਾ ਕਰਨੀ ਪੈਣੀ ਹੈ ਤੇ ਤੁਹਾਨੂੰ ਦਸ ਪੰਦਰਾਂ ਦਿਨ ਵੇਟ ਕਰਨੀ ਪੈਣੀ ਹੈ ਜਲਦੀ ਪਤਾ ਤੁਹਾਨੂੰ ਕਦੋਂ ਤੱਕ ਚਾਹੀਦੇ ਚਾਰ ਪੰਜ ਕੱਲ ਤੱਕ ਦਾ ਤਾਂ ਔਖਾ ਹੈ ਫਿਰ ਮੈਂ ਕੋਸ਼ਿਸ਼ ਕਰਾਂਗਾ ਆਪਦੇ ਵੱਲੋਂ ਤੇ ਫਿਰ ਮੈਂ ਤੁਹਾਨੂੰ ਫੋਨ ਕਰਦਾ ਜੇ ਆਪ ਮਿਲੇਗੀ ਤਾਂ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਕਰਦਾ ਓਕੇ